ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਕੱਲ੍ਹ ਬਠਿੰਡਾ ਦੀ ਸਵੀਟ ਰੈਸਟੋਰੈਂਟ ਤੋਂ ਇੱਕ ਚੋਕਲੇਟ ਕੇਕ ਔਡਰ ਕੀਤਾ ਹੋਇਆ ਸੀ ਇਹ ਕੇਕ ਮੈਂ ਖੁਦ ਦੁਕਾਨ 'ਤੇ ਜਾ ਕੇ ਔਡਰ ਕੀਤਾ ਸੀ ਅਤੇ ਮੈਂ ਆਪਣੇ ਭਰਾ ਦੇ ਜਨਮਦਿਨ 'ਤੇ ਉਹਨੂੰ ਇੱਕ ਗਿਫਟ ਦੇਣਾ ਚਾਹੁੰਦੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਹ ਕੇਕ ਖੁਦ ਆ ਕੇ ਲੈ ਜਾਵਾਂਗੀ ਪ੍ਰੰਤੂ ਉਹਨਾਂ ਨੇ ਕਿਹਾ ਕਿ ਅਸੀਂ ਇਹ ਤੁਹਾਡੇ ਘਰ ਪਹੁੰਚਾ ਦੇਵਾਂਗੇ ਅੱਜ ਜਦੋਂ ਅਸੀਂ ਘਰ ਦੇ ਵਿੱਚ ਪਾਰਟੀ ਰੱਖੀ ਹੋਈ ਹੈ ਸਾਰੇ ਮਹਿਮਾਨ ਪਹੁੰਚ ਚੁੱਕੇ ਹਨ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਹਨ ਤਾਂ ਜਦੋਂ ਕੇਕ ਦਾ ਸਮਾਂ ਹੋਇਆ ਅਤੇ ਮੈਂ ਜਦੋਂ ਖੋਲ੍ਹ ਕੇ ਦੇਖਿਆ ਤਾਂ ਉਹ ਬਹੁਤ ਜ਼ਿਆਦਾ ਖਰਾਬ ਸੀ ਅਜਿਹੀ ਸਥਿੱਤੀ ਦੇ ਵਿੱਚ ਮੈਂ ਕੀ ਕਰ ਸਕਦੀ ਹਾਂ ਤਾਂ ਮਨ ਮੇਰਾ ਬਹੁਤ ਖਰਾਬ ਹੋਇਆ ਕਿਉਂਕਿ ਮੈਂ ਉਹਨੂੰ ਇੱਕ ਸਰਪ੍ਰਾਈਜ਼ ਗਿਫਟ ਦੇਣਾ ਸੀ ਆਪਣੇ ਭਰਾ ਨੂੰ ਤਾਂ ਉਹ ਸਾਰਾ ਹੀ ਚੋਕਲੇਟ ਦਾ ਜਿਹੜਾ ਫਲੇਵਰ ਆ ਸਾਰੀ ਉਹਦੀ ਪੈਕੇਜਿੰਗ ਬਹੁਤ ਜ਼ਿਆਦਾ ਖਰਾਬ ਸੀ ਤਾਂ ਮੈਂ ਮੈਨੂੰ ਇਸ ਦੇ ਵਿੱਚ ਜਿਹੜੇ ਮੇਰੇ ਕੇਕ ਦੀ ਰਿਫੰਡ ਕੀਤਾ ਜਾਵੇ ਜਾਂ ਇਹਨੂੰ ਬਦਲਿਆ ਜਾਵੇ ਤਾਂ ਹੁਣ ਮੈਂ ਚਾਹੁੰਦੀ ਹਾਂ ਕਿ ਵੀ ਪੰਦਰਾਂ ਵੀਹ ਮਿੰਟਾਂ ਦੇ ਵਿੱਚ ਤੁਸੀਂ ਇਹ ਕੇਕ ਆ ਜਿਹੜਾ ਮੈਨੂੰ ਹੋਰ ਇਹ ਦੀ ਥਾਂ 'ਤੇ ਇੱਕ ਕੇਕ ਆ ਜਿਹੜਾ ਭੇਜਿਆ ਜਾ ਸ ਭੇਜਿਆ ਜਾ ਸਕੇ ਤਾਂ ਜੋ ਜਿਹੜਾ ਸਾਡੀ ਜਿਹੜੀ ਪਾਰਟੀ ਆ ਉਹ ਸਹੀ ਰੂਪ ਦੇ ਵਿੱਚ ਚੱਲ ਸਕੇ